ਬੋਲੀਵੁੱਡ ਟੋਲੀਵੁੱਡ 'ਚ ਬਹੁਤ ਜ਼ਿਆਦਾ ਫਿਲਮਾਂ ਆਈਆਂ ਹਨ ਹੈ ਨਾ ਜਿਨ੍ਹਾਂ ਨੇ ਪੂਰੇ ਪੰਜਾਬ ਜਾਂ ਹਰ ਇੱਕ ਜਾਣਾ ਵੱਡੇ ਤੋਂ ਲੈ ਕੇ ਛੋਟਾ ਹੈ ਨਾ ਉਹ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਅੱਜ ਕੱਲ੍ਹ ਦੇ ਫੈਸ਼ਨ ਨਾਲ ਫੈਸ਼ਨ ਬਹੁਤ ਜਲਦੀ ਬਦਲਦਾ ਰਹਿੰਦਾ ਪਹਿਲਾਂ ਜਿਵੇਂ ਆਪਾਂ ਏਟੀਜ਼ ਅੱਸੀ ਨੱਬੇ ਇਹਨਾਂ ਦੇ ਸਾ ਅ ਸਾਲਾਂ 'ਚ ਜਾ ਕੇ ਦੇਖੀਏ ਤਾਂ ਫੈਸ਼ਨ ਦਾ ਮਤਲਬ ਕੁਛ ਹੋਰ ਸੀ ਜਿਵੇਂ ਕਿ ਸਿਰ ਢੱਕਿਆ ਹੋਣਾ ਡੀਪ ਗਲੇ ਨਹੀਂ ਪਾਉਣੇ ਜਾਂ ਹੱਥ ਨਾਲ ਕੀਤੀਆਂ ਹੋਈਆਂ ਕਢਾਈਆਂ ਵਾਲੇ ਸੂਟ ਪਾਉਣੇ ਜਾਂ ਜਿਹੜੀਆਂ ਸਕਰਟਾਂ ਵੀ ਹੁੰਦੀਆਂ ਸੀ ਉਹ ਵੀ ਗੋਡੇ ਤੋਂ ਥੱਲੇ ਤੱਕ ਦੀਆਂ ਹੁੰਦੀਆਂ ਸੀ ਸਾਰਾ ਕੁਛ ਹੱਥ ਨਾਲ ਬੁਣਿਆ ਹੋਇਆ ਜਾਂ ਹੱਥਾਂ ਦਾ ਕੰਮ ਜ਼ਿਆਦਾ ਕੀਤਾ ਹੁੰਦਾ ਸੀ ਕੱਪੜਿਆਂ 'ਤੇ ਅਤੇ ਅੱਜ ਕੱਲ੍ਹ ਜੇ ਆਪਾਂ ਚਲੀਏ ਜਾਂ ਕੁਝ ਪਿੱਛਲੇ ਕੁਛ ਕੁ ਪੰਜ ਸਾਲ ਜਾਂ ਦਸ ਸਾਲ ਤੋਂ ਦੇਖੀਏ ਤਾਂ ਮਸ਼ੀਨੀ ਕੰਮ ਜ਼ਿਆਦਾ ਚੱਲਦਾ ਅਤੇ ਉਹ ਹੀ ਕੰਮ ਬੋਲੀਵੁੱਡ ਟੋਲੀਵੁੱਡ 'ਚ ਹੁੰਦਾ ਬੋਲੀਵੁੱਡ 'ਚ ਤਾਂ ਜਿਵੇਂ ਸਕਸ ਸਕਰਟਾਂ ਹੋ ਗਈਆਂ ਜਾਂ ਕੋਈ ਵੀ ਹੋਰ ਕੱਪੜਾ ਹੈ ਉਹ ਬਹੁਤ ਹੀ ਛੋਟੇ ਤੋਂ ਛੋਟਾ ਕਰੀ ਜਾਂਦੇ ਆ ਜੋ ਕਿ ਇਹ ਲੋਕਾਂ 'ਤੇ ਜਾਂ ਬਾਕੀ ਇਨਸਾਨਾਂ 'ਤੇ ਡਿਪੈਂਡ ਕਰਦਾ ਵੀ ਉਹ ਉਸ ਚੀਜ਼ ਨੂੰ ਪਸੰਦ ਕਰਦੇ ਆ ਕਿ ਨਹੀਂ ਬਟ ਜੋ ਟੋਲੀਵੁੱਡ ਆ ਉਹ ਹਜੇ ਵੀ ਕਿਤੇ ਨਾ ਕਿਤੇ ਜੋ ਸੂਟ ਨੇ ਉਹ ਉਹਨਾਂ ਦੇ ਸਹੀ ਸੂਟ ਹੁੰਦੇ ਹਨ ਵੀ ਮਤਲਬ ਜੋ ਡਿਜ਼ਾਇਨਰ ਸੂਟ ਜਿਨ੍ਹਾਂ ਨੂੰ ਕਹਿੰਦੇ ਹੈ ਅਤੇ ਬੋਲੀਵੁੱਡ ਤੋਂ ਟੋਲੀਵੁੱਡ ਦੋਨਾਂ 'ਤੇ ਸੂਟਾਂ ਦਾ ਅੱਡ ਅੱਡ ਫਰਕ ਹੈ ਅਤੇ ਅੱਡ ਅੱਡ ਪ੍ਰਭਾਵ ਹੈ ਜਿਹੜਾ ਬੋਲੀਵੁੱਡ ਹੈ ਉਹਦੇ ਸੂਟ ਜੇ ਤੁਸੀਂ ਦੇਖੋ ਤਾਂ ਉਹ ਸੂਟ ਪ੍ਰੋਪਰ ਨਹੀਂ ਹੁੰਦੇ ਉਹ ਸੂਟਾਂ ਦਾ ਅ ਜੇ ਗਲਾ ਵੀ ਬਹੁਤ ਵੱਡਾ ਹੁੰਦਾ ਨਾ ਉਹ ਸੂਟਾਂ ਦੀ ਕੋਈ ਉਹ ਸੈਂਸ ਬਣਦੀ ਹੁੰਦੀ ਹੈ ਲੇਕਿਨ ਜਿਹੜਾ ਟੋਲੀਵੁੱਡ ਹੈ ਉਹ ਜਿਵੇਂ ਕਿ ਪੰਜਾਬ ਦੇ ਸੂਟਾਂ ਦਾ ਪਹਿਰਾਵਾ ਹੈ ਉਹ ਉਹਨੂੰ ਉਵੇਂ ਰੱਖਦਾ ਅਤੇ ਉਵੇਂ ਹੀ ਫਿਰ ਇਲਾਕਿਆਂ 'ਤੇ ਫਰਕ ਪੈਂਦਾ ਅੱਜ ਕੱਲ੍ਹ ਤਾਂ ਰੈਡੀਮੇਡ ਸੂਟ ਵੀ ਆਉਣ ਲੱਗ ਗਏ ਆ ਵੀ ਪੈਸੇ ਦਿਉ ਅਤੇ ਤੁਹਾਨੂੰ ਨਾਲ ਦੀ ਨਾਲ ਬਣਿਆ ਬਣਾਇਆ ਸੂਟ ਮਿਲ ਜਾਂਦਾ ਫਰੀ ਸਾਈਜ਼ ਜਿਹਨੂੰ ਆਪਾਂ ਕਹਿੰਦੇ ਆ ਵੀ ਖੁੱਲ੍ਹਾ ਸਾਈਜ਼ ਆਉਂਦਾ ਉਹ ਚੀਜ਼ ਲੇਕਿਨ ਪਹਿਲਾਂ ਐਵੇਂ ਦਾ ਕੁਛ ਨਹੀਂ ਸੀ ਹੁੰਦਾ ਮੇਰੇ ਹਿਸਾਬ ਨਾਲ ਮੈਂ ਜਿਵੇਂ ਕਿ ਕੁਛ ਕ ਮੂਵੀ ਆਈਆਂ ਹਨ ਜਿਵੇਂ ਕਿ ਅਰਦਾਸ ਕਲਾ ਹੋ ਗਈ ਜਾਂ ਸਿੰਮੀ ਚਹਿਲ ਦੀਆਂ ਮੂਵੀਆਂ ਹੋ ਗਈਆਂ ਜਿਹਨਾਂ 'ਚ ਉਹਨਾਂ ਨੇ ਬਹੁਤ ਸੋਹਣੇ ਸੂਟ ਪਾਏ ਸੀ ਜਿਵੇਂ ਨਿਮਰਤ ਖਹਿਰਾ ਹੈ ਇਹਨਾਂ ਦੇ ਜਿਹੜੇ ਸੂਟ ਹੁੰਦੇ ਆ ਉਹ ਵਧੀਆ ਹੁੰਦੇ ਆ ਪ੍ਰੋਪਰ ਡਿਜ਼ਾਇਨਿੰਗ ਹੁੰਦੇ ਆ ਕਿਤੇ ਕਢਾਈ ਕੀਤੀ ਹੁੰਦੀ ਹੈ ਕੋਈ ਪ੍ਰਿੰਟ ਵਾਲਾ ਸੂਟ ਹੁੰਦਾ ਹੈ ਨਾ ਤਾਂ ਉਹ ਇੱਕ ਤਰ੍ਹਾਂ ਕਈ ਮੂਵੀ ਸੂਟਸ ਨੂੰ ਪ੍ਰਮੋਟ ਕਰਦੀਆਂ ਨੇ ਹੈ ਨਾ ਅਤੇ ਕਈ ਅੱਡ ਅੱਡ ਫੈਸ਼ਨਸ ਨੂੰ ਮੈਂ ਸਿੰਮੀ ਚਹਿ ਅ ਸਿੰਮੀ ਨਿਮਰਤ ਖਹਿਰਾ ਇਹਨਾਂ ਦੇ ਦਾ ਜੋ ਪਹਿਰਾਵਾ ਹੁੰਦਾ ਮੂਵੀਆਂ 'ਚ ਉਵੇਂ ਦੀ ਮੂਵੀਆਂ ਤੋਂ ਸੂਟ ਦੇਖ ਕੇ ਲੈ ਪਹਿਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਅਤੇ ਇੱਦਾਂ ਦੇ ਸੂਟ ਮਹਿੰਗੇ ਵੀ ਮਿਲਦੇ ਹਨ ਖਾਸੇ ਅਤੇ ਇਹਨਾਂ ਨੂੰ ਸਮਾਂ ਵੀ ਬਹੁਤ ਲੱਗਦਾ ਬਣਨ ਦਾ ਕਿਉਂਕਿ ਇਹਨਾਂ 'ਤੇ ਪ੍ਰੋਪਰ ਪੂਰੀ ਚੰਗੀ ਤਰ੍ਹਾਂ ਮੀਨਾਕਾਰੀ ਕੀਤੀ ਜਾਂਦੀ ਹੁੰਦੀ ਆ